ਮੈਨੂੰ ਲੱਗਦਾ ਹੈ ਕਿ ਸਾਡੇ ਖੇਤਰ ਦੇ ਵਿੱਚ ਕੱਪੜਿਆਂ ਦਾ ਕੰਮ ਕੀਤਾ ਜਾ ਸਕਦਾ ਹੈ ਕਿਉਂਕਿ ਸਾਡੇ ਖੇਤਰ ਦੇ ਵਿੱਚ ਕੋਈ ਵੀ ਕੱਪੜੇ ਦੀ ਦੁਕਾਨ ਨਹੀਂ ਹੈ ਇਸ ਕਰਕੇ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਸਾਡੇ ਪਿੰਡ ਵਾਲਿਆਂ ਨੂੰ ਦੂਸਰੇ ਸ਼ਹਿਰ ਜਾ ਕੇ ਕੱਪੜੇ ਖਰੀਦਣੇ ਪੈਂਦੇ ਹਨ ਜੋ ਕਿ ਬਹੁਤ ਹੀ ਮੁਸ਼ਕਿਲ ਕੰਮ ਹੈ ਕਈ ਵਾਰ ਤਾਂ ਇੱਦਾਂ ਹੁੰਦਾ ਹੈ ਕਿ ਸਾਨੂੰ ਕੱਪੜੇ ਦੀ ਜ਼ਰੂਰਤ ਹੁੰਦੀ ਹੈ ਪਰ ਮੌਸਮ ਖਰਾਬ ਹੋਣ ਦੇ ਕਾਰਨ ਬਜ਼ਾਰ ਜਾਣਾ ਬਜ਼ਾਰ ਜਾਣ ਵਾਲੇ ਆਟੋ ਰਿਕਸ਼ਾ ਨਹੀਂ ਮੰਨਦੇ ਤਾਂ ਇਸ ਕਰਕੇ ਸਾਡੇ ਉਹ ਫੰਕਸ਼ਨ ਅਧੂਰੇ ਰਹਿ ਜਾਂਦੇ ਹਨ ਤਾਂ ਮੈਂ ਚਾਹੁੰਦੀ ਹਾਂ ਕਿ ਸਾਡੇ ਖੇਤਰ ਦੇ ਵਿਚ ਕੱਪੜਿਆਂ ਦਾ ਕੰਮ ਖੁੱਲ੍ਹ ਕੱਪੜੇ ਦੀ ਦੁਕਾਨ ਖੋਲ੍ਹਣੀ ਚਾਹੀਦੀ ਹੈ ਵੈਸੇ ਸਾਡੇ ਪਿੰਡ ਵਿੱਚ ਬੁਟੀਕ ਤਾਂ ਕਾਫੀ ਨੇ ਪਰ ਕੱਪੜਿਆਂ ਦੀ ਦੁਕਾਨ ਇੱਕ ਵੀ ਨਹੀਂ ਜੇਕਰ ਕੱਪੜਿਆਂ ਦੀ ਦੁਕਾਨ ਖੁੱਲ੍ਹ ਜਾਵੇਗੀ ਤਾਂ ਇਸ ਨਾਲ ਪਿੰਡ ਵਾਲਿਆਂ ਨੂੰ ਵੀ ਰੁਜ਼ਗਾਰ ਦਾ ਸਾਧਨ ਮਿਲ ਜਾਵੇਗਾ ਕਿਉਂਕਿ ਜਿਹੜੀ ਵੀ ਕੱਪੜੇ ਦੀ ਦੁਕਾਨ ਖੁੱਲ੍ਹੇਗੀ ਉਸ ਦੁਕਾਨ 'ਤੇ ਲੜਕੇ ਲੜਕਿਆਂ ਦਾ ਲੜਕੇ ਲੜਕੀਆਂ ਨੂੰ ਕੰਮ ਕਰਨਾ ਪਵੇਗਾ ਅਤੇ ਉਹ ਪਿੰਡ ਦੇ ਹੀ ਹੋਣਗੇ ਜਿਸ ਨਾਲ ਰੁਜ਼ਗਾਰ ਵਧੇਗਾ ਸਾਡੇ ਪਿੰਡ ਦੇ ਵਿਚ ਮੱਛੀ ਫਾਰਮ ਦਾ ਕੰਮ ਵੀ ਕ ਕੰਮ ਵੀ ਹੋ ਸਕਦਾ ਹੈ ਕਿਉਂਕਿ ਸਾਡੇ ਪਿੰਡ ਦਾ ਮੈਦਾਨ ਕਾਫੀ ਖੁੱਲੇ ਹਨ ਅਤੇ ਉਸ ਉਸ ਜਗਹਾ ਇਹ ਕੰਮ ਬਹੁਤ ਤਰੱਕੀ ਕਰੇਗਾ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਪਿੰਡ ਵਿੱਚ ਮੱਛੀ ਫਾਰਮ ਦਾ ਕੰਮ ਅਤੇ ਕੱਪੜਿਆਂ ਦੀ ਦੁਕਾਨ ਦਾ ਖੁੱਲ੍ਹਣਾ ਬਹੁਤ ਹੀ ਲਾਜ਼ਮੀ ਹੈ ਇਸ ਨਾਲ ਬਹੁਤ ਇਸ ਨਾਲ ਬਹੁਤ ਲੋਕਾਂ ਨੂੰ ਸਹਾਇਤਾ ਮਿਲੇਗੀ